ਸਤਿ ਸ਼੍ਰੀ ਅਕਾਲ ਜੀ ਵਿਸਾਖੀ ਅਤੇ ਲੋਹੜੀ ਦੋ ਵੱਡੇ ਤਿਉਹਾਰ ਪੰਜਾਬ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਨੇ ਵਿਸਾਖੀ ਤਾਂ ਜੀ ਮੇਨਲੀ ਮਨਾਇਆ ਜਾਂਦਾ ਮੁੱਖ ਇਹ ਤਾਂ ਜਿਵੇਂ ਫਸਲ ਕੱਟੀ ਜਾਂਦੀ ਹੈ ਉਹਦੇ ਬਾਅਦ ਕਿਸਾਨ ਸਾਰੇ ਇਕੱਠੇ ਹੋ ਕੇ ਉਹਨੂੰ ਇੰਜੋਏ ਕਰਦੇ ਨੇ ਖੁਸ਼ੀ ਮਨਾਉਂਦੇ ਨੇ ਅਤੇ ਪਤੰਗਾਂ ਉਡਾਉਂਦੇ ਨੇ ਅਤੇ ਲੋਹੜੀ ਜਿਹੜਾ ਤਿਉਹਾਰ ਹੈਗਾ ਉਹ ਜਿਵੇਂ ਅੱਗ ਬਾਲ ਕੇ ਸਾਰੇ ਇਕੱਠੇ ਬਹਿੰਦੇ ਹੈ ਅਤੇ ਮੂੰਗਫਲੀਆਂ ਰਿਓੜੀਆਂ ਖਾਂਦੇ ਹਨ ਢੋਲ ਵਜਾਉਂਦੇ ਆ ਗਾਣੇ ਗਾਉਂਦੇ ਆ ਬੋਲੀਆਂ ਪਾਉਂਦੇ ਹੈ ਇਹ ਤਿਉਹਾਰ ਮੁੱਖ ਰੂਪ ਸੇ ਇਹਦੇ ਲਈ ਮਨਾਇਆ ਜਾਂਦਾ ਕਿਉਂਕਿ ਕਹਿੰਦੇ ਆ ਵੀ ਇਹ ਮੰਨਿਆ ਜਾਂਦਾ ਵੀ ਅਕਬਰ ਦੇ ਟਾਈਮ ਦੇ ਵਿੱਚ ਇੱਕ ਦੁੱਲਾ ਭੱਟੀ ਨਾਮ ਦਾ ਬੰਦਾ ਹੁੰਦਾ ਸੀ ਅਤੇ ਉਹਨੇ ਵਪਾਰੀਆਂ ਨੂੰ ਕੋਈ ਮੁਗਲ ਸੀਗੇ ਜਿਹੜੇ ਵਪਾਰੀਆਂ ਨੂੰ ਕੁੜੀਆਂ ਵੇਚਣ ਦੇ ਲਈ ਜਾ ਰਹੇ ਸੀ ਅਤੇ ਦੁੱਲੇ ਭੱਟੀ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਸਾਰੀਆਂ ਕੁੜੀਆਂ ਨੂੰ ਛਡਾ ਕੇ ਅਤੇ ਉਹਨਾਂ ਦਾ ਵਿਆਹ ਕਰਾਇਆ ਅਤੇ ਉਹਦੇ ਬਾਅਦ ਪੰਜਾਬ ਦੇ ਲੋਕ ਅੱਗੇ ਤੋਂ ਅੱਗੇ ਆਪਣੇ ਜਵਾਕਾਂ ਨੂੰ ਇਹ ਕਹਾਣੀ ਸੁਣਾ ਕੇ ਦੁੱਲੇ ਭੱਟੀ ਨੂੰ ਇੱਕ ਦਿਨ ਲੋਹੜੀ ਵਾਲੇ ਦਿਨ ਯਾਦ ਕਰਦੇ ਨੇ ਅਤੇ ਉਹਨਾਂ ਨੂੰ ਉਹਦੀਆਂ ਕਹਾਣੀਆਂ ਸੁਣਾਉਂਦੇ ਨੇ ਅਤੇ ਨਾਲੇ ਇਕੱਠੇ ਬਹਿ ਕੇ ਸਾਰੇ ਖੁਸ਼ੀਆਂ ਮਨਾਉਂਦੇ ਨੇ ਅਤੇ ਅੱਗ ਬਾਲ ਕੇ ਅਤੇ ਮੂੰਗਫਲੀਆਂ ਰੇਵੜੀਆਂ ਅਤੇ ਇਹ ਚੀਜ਼ਾਂ ਵੰਡ ਕੇ ਅਤੇ ਗਾਣੇ ਚਲਾ ਕੇ ਢੋਲ ਵਜਾ ਕੇ ਦੁੱਲੇ ਪੱਟੀ ਨੂੰ ਯਾਦ ਕਰਦੇ ਨੇ